ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੀਰਤ ਸਿੰਘ ਹੈ ਮੈਂ ਪਠਾਨਕੋਟ ਵਿੱਚ ਰਹਿੰਦਾ ਹਾਂ ਮੈਂ ਚੰਡੀਗੜ੍ਹ ਪਹਿਲੀ ਵਾਰ ਆਇਆ ਹਾਂ ਕੀ ਤੁਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਜੇ ਹਾਂ ਤਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇੱਥੇ ਨੇੜੇ ਕੋਈ ਆਟੋ ਸਟੈਂਡ ਜਾਂ ਰਿਕਸ਼ਾ ਸਟੈਂਡ ਹੈ ਕਿਉਂਕਿ ਮੈਂ ਕਿੰਨੀ ਦੇਰ ਤੋਂ ਔਨਲਾਈਨ ਕੈਬ ਬੁੱਕ ਕਰ ਰਿਹਾ ਹਾਂ ਜੋ ਕਿ ਨਹੀਂ ਹੋ ਪਾ ਰਹੀ ਜਿਸ ਕਾਰਨ ਮੈਂ ਬਹੁਤ ਹੀ ਪਰੇਸ਼ਾਨ ਹਾਂ ਫੋਨ ਵਿੱਚ ਸਭ ਬੁਕਿੰਗਾਂ ਫੁੱਲ ਦਿਖਾਈਆਂ ਜਾ ਰਹੀਆਂ ਹਨ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਰੇਲਵੇ ਸਟੇਸ਼ਨ ਦੇ ਨੇੜੇ ਕੋਈ ਆਟੋ ਜਾਂ ਟੈਕਸੀ ਸਟੈਂਡ ਹੈ ਜਿੱਥੋਂ ਮੈਨੂੰ ਆਸਾਨੀ ਨਾਲ ਟੈਕਸੀ ਮਿਲ ਸਕੇ ਤਾਂ ਜੋ ਮੈਂ ਆਪਣੀ ਜਗ੍ਹਾ 'ਤੇ ਜਲਦੀ ਤੋਂ ਜਲਦੀ ਪਹੁੰਚ ਸਕਾਂ ਕਿਉਂਕਿ ਮੈਨੂੰ ਚੰਡੀਗੜ੍ਹ ਸੈਕਟਰ ਬਾਰਾਂ ਵਿੱਚ ਜਾਣਾ ਹੈ ਮੇਰਾ ਇੱਥੇ ਜਾਣਾ ਬਹੁਤ ਹੀ ਜ਼ਰੂਰੀ ਹੈ ਸੈਕਟਰ ਬਾਰਾਂ ਵਿੱਚ ਮੈਨੂੰ ਬਹੁਤ ਹੀ ਜ਼ਰੂਰੀ ਕੰਮ ਹੈ ਸੈਕਟਰ ਬਾਰਾਂ ਵਿੱਚ ਮੈਨੂੰ ਜਲਦੀ ਤੋਂ ਜਲਦੀ ਪਹੁੰਚਣਾ ਹੈ ਜਿਸ ਨਾਲ ਮੇਰਾ ਕੰਮ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਕੰਮ ਖਤਮ ਕਰਕੇ ਮੈਨੂੰ ਆਪਣੇ ਸ਼ਹਿਰ ਪਠਾਨਕੋਟ ਵੀ ਜਾਣਾ ਹੈ ਜੋ ਕਿ ਮੈਂ ਅੱਜ ਹੀ ਜਾਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਮੈਨੂੰ ਇਹ ਕੰਮ ਬਹੁਤ ਜ਼ਰੂਰੀ ਹੈ ਜੋ ਆਟੋ ਜੇ ਕੋਈ ਆਟੋ ਹੈ ਜੋ ਮੈਨੂੰ ਸੈਕਟਰ ਬਾਰਾਂ ਤੱਕ ਛੱਡ ਸਕੇ ਤਾਂ ਮੈਨੂੰ ਕਿਰਪਾ ਕਰਕੇ ਦੱਸ ਦਿਓ ਜੇ ਕੋਈ ਨੇੜੇ ਆਟੋ ਸਟੈਂਡ ਜਾਂ ਰਿਕਸ਼ਾ ਸਟੈਂਡ ਹੈ ਤਾਂ ਦੱਸੋ ਮੈਂ ਉੱਥੇ ਜਾ ਕੇ ਜਲਦੀ ਤੋਂ ਜਲਦੀ ਆਟੋ ਫੜ ਕੇ ਅਤੇ ਜਲਦੀ ਤੋਂ ਜਲਦੀ ਆਪਣਾ ਕੰਮ ਖਤਮ ਕਰ ਸਕਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ